ਪੰਜਾਬ ਵਿੱਚ ਪੰਜਾਬੀ ਸੱਭਿਆਚਾਰ ਨੂੰ ਪੰਜਾਬ ਵਿੱਚ ਸਭ ਤੋਂ ਮੁੱਖ ਮੰਨਿਆ ਜਾਂਦਾ ਹੈ ਇਸ ਤੋਂ ਬਿਨਾ ਪੰਜਾਬ ਵਿੱਚ ਪੰਜਾਬੀ ਸੱਭਿਆਚਾਰ ਤੋਂ ਬਿਨਾ ਸਾਨੂੰ ਇਹ ਜਿਹੜੇ ਰੀਤੀ ਰਿਵਾਜ਼ ਹਨ ਸਾਰੇ ਕੁਛ ਇਹ ਪੰਜਾਬੀ ਸੱਭਿਆਚਾਰ ਦੇ ਵਿੱਚ ਹੀ ਮਿਲਦੇ ਹਨ ਪੰਜਾਬ ਵਿੱਚ ਪੰਜਾਬੀ ਸੱਭਿਆਚਾਰ ਦੇ ਵਿੱਚ ਹਰ ਇੱਕ ਤਿਉਹਾਰ ਹਰ ਇੱਕ ਦਿਨ ਸ ਜਿਵੇਂ ਸ ਰੀਤੀ ਰਿਵਾਜ਼ਾਂ ਦੇ ਨਾਲ ਹੀ ਮਨਾਇਆ ਜਾਂਦਾ ਹੈ ਪੰਜਾਬ ਵਿੱਚ ਪੰਜਾਬ ਦੀਆਂ ਕੁੜੀਆਂ ਨੇ ਉਹ ਮਤਲਬ ਕਿ ਸਿਰ 'ਤੇ ਚੁੰਨੀ ਲੈ ਕੇ ਰੱਖਦੀਆਂ ਹਨ ਪੰਜਾਬੀ ਸੂਟ ਪਾਉਂਦੀਆਂ ਹਨ ਸਾਡੇ ਧਾਰਮਿਕ ਵਿਹਾਰਾਂ ਦੇ ਵਿੱਚ ਵੀ ਪੰਜਾਬ ਦੀਆਂ ਕੁੜੀਆਂ ਜਦੋਂ ਪੰਜਾਬ ਵਿ ਕਿਸੇ ਗੁਰਦੁਆਰੇ ਵਿੱਚ ਅਸੀਂ ਜਾਂਦੇ ਹਾਂ ਕਿਤੇ ਵੀ ਧਾਰਮਿਕ ਸਥਾਨ 'ਤੇ ਜਾਂਦੇ ਹਾਂ ਤਾਂ ਅਸੀਂ ਪੰਜਾ ਸਿਰ 'ਤੇ ਚੁੰਨੀ ਲੈ ਕੇ ਸਿਰ ਢੱਕ ਕੇ ਜਾਂਦੇ ਹਾਂ ਇਹੀ ਸਾਰਾ ਕੁਛ ਸਾਨੂੰ ਪੰਜਾਬੀ ਸੱਭਿਆਚਾਰ ਵਿੱਚ ਸਿਖਾਇਆ ਜਾਂਦਾ ਹੈ ਧਰਮ ਨੂੰ ਮੰਨਣਾ ਉਹਦੀ ਪਾਲਣਾ ਕਰਨੀ ਵੱਡਿਆਂ ਦਾ ਆਦਰ ਕਰਨਾ ਵੱਡਿਆਂ ਨਾਲ ਗੱਲ ਕਰਨੀ ਤਾਂ ਤੁਸੀਂ ਹਮੇਸ਼ਾ ਅੱਖ ਨੀਵੀਂ ਕਰਕੇ ਗੱਲ ਕਰਨੀ ਵੱਡਿਆਂ ਦੇ ਸਾਹਮਣੇ ਸਿਰ ਝੁਕਾਅ ਕੇ ਗੱਲ ਕਰਨੀ ਇਹ ਸਭ ਕੁਝ ਸਾਨੂੰ ਪੰਜਾਬੀ ਸੱਭਿਆਚਾਰ ਦੇ ਵਿੱਚ ਹੀ ਸਿੱਖਣ ਨੂੰ ਮਿਲਦਾ ਹੈ ਇਹ ਪੰਜਾਬੀ ਸੱਭਿਆਚਾਰ ਦੇ ਵਿੱਚ ਹਰ ਇੱਕ ਜਿਹੜਾ ਤਿਉਹਾਰ ਹੈਗਾ ਰੀਤੀ ਰਿਵਾਜ਼ ਸਭ ਵੱਖ ਵੱਖ ਤਰੀਕਿਆਂ ਦੇ ਨਾਲ ਮਨਾਏ ਜਾਂਦੇ ਹਨ ਪੰਜਾਬ ਵਿੱਚ ਪੰਜਾਬੀ ਸੱਭਿਆਚਾਰ ਨੂੰ ਰੀਤੀ ਰਿਵਾਜ਼ਾਂ ਅਤੇ ਖਾਣ ਪੀਣ ਪਹਿਨਣ ਪਹਿਰਾਵੇ ਤੋਂ ਹੀ ਸਾਨੂੰ ਪੰਜਾਬੀ ਸੱਭਿਆਚਾਰ ਦੀ ਪਹਿਚਾਣ ਹੁੰਦੀ ਹੈ ਪੰਜਾਬੀ ਸੱਭਿਆਚਾਰ ਵਿੱਚ ਪੰਜਾਬ ਵਿੱਚ ਮੁੰਡੇ ਸਿਰ 'ਤੇ ਪੱਗਾਂ ਬੰਨ੍ਹਦੇ ਹਨ ਅਤੇ ਕੁੜੀਆਂ ਸਿਰ 'ਤੇ ਚੁੰਨੀਆਂ ਲੈਂਦੀਆਂ ਹਨ ਅਤੇ ਆਪਣੇ ਤੋਂ ਵੱਡਿਆਂ ਦਾ ਸਤਿਕਾਰ ਕਰਦੇ ਹਨ ਅਤੇ ਸਾਨੂੰ ਪੰਜਾਬ ਵਿੱਚ ਪੰਜਾ ਇਹ ਸਾਰਾ ਕੁਛ ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਦੇਖਣ ਨੂੰ ਮਿਲਦਾ ਹੈ